ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਪਿੰਡਾਂ ਦੇ ਲੋਕ ਆਪਣੀ ਰਵਾਇਤੀ ਸੱਭਿਆਚਾਰ ਕਦਰਾਂ ਕੀਮਤਾਂ ਨੂੰ ਮੰਨੋਰੰਜਨ ਦੇ ਅਧਿਐਨ ਆਧੁਨਿਕ ਰੂਪਾਂ ਜਿਵੇਂ ਬਾਹਰ ਜਾਣਾ ਪਾਰਟੀ ਕਰਨਾ ਵੱਡੇ ਜਸ਼ਨਾਂ ਵਿੱਚ ਅਤੇ ਸ਼ਰਾਬ ਪੀਣ ਵਿੱਚ ਕਰ ਕਰਦੇ ਹਨ ਮੈਂ ਇਹਨਾਂ ਵਿੱਚੋਂ ਕੁਝ ਨਹੀਂ ਕਰਦਾ ਹਾਂ ਮੇਰੀ ਮਾਨਤਾ ਇਹ ਹੈ ਕਿ ਆਪਾ ਨੂੰ ਛੋਟੇ ਪੱਧਰ 'ਤੇ ਜਸ਼ਨ ਮਨਾਉਣਾ ਚਾਹੀਦਾ ਹੈ ਆਪਣੇ ਪਰਿਵਾਰ ਦੇ ਮੈਂਬਰਾਂ ਵਿੱਚ ਰਲ ਕੇ ਜਸ਼ਨ ਮਨਾਉਣਾ ਚਾਹੀਦਾ ਹੈ ਇਸ ਵਿੱਚ ਬਹੁਤ ਹੀ ਸਾਰੇ ਲਾਭ ਹਨ ਪਹਿਲਾਂ ਲਾਭ ਆਪਣੀ ਆਰਥਿਕ ਸਥਿਤੀ ਵਾਸਤੇ ਹੈ ਜੇ ਆਪਾਂ ਵੱਡਾ ਜਸ਼ਨ ਕਰਦੇ ਹਾਂ ਤਾਂ ਜੇ ਵੱਡੇ ਜਿਆਦਾ ਲੋਕਾਂ ਨੂੰ ਬੁਲਾਉਂਦੇ ਹਾਂ ਤਾਂ ਜ਼ਿਆਦਾ ਪੈਸੇ ਲੱਗਦੇ ਹਨ ਜੋ ਕਿ ਆਰਥਿਕ ਸਥਿਤੀ ਸਥਿਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਜ਼ਿਆਦਾ ਹੀ ਫਾਇਦੇਮੰਦ ਵੀ ਨਹੀਂ ਹੁੰਦਾ ਛੋਟੇ ਜਸ਼ਨ ਕਰਕੇ ਆਪਾਂ ਆਪਣੇ ਪਰਿਵਾਰ ਦੇ ਲੋਕਾਂ ਵਿੱਚ ਹੀ ਖੁਸ਼ ਰਹਿ ਸਕਦੇ ਹਾਂ ਅਤੇ ਮੈਂ ਜੋ ਵੀ ਜਸ਼ਨ ਕਰਦਾ ਹਾਂ ਉਹ ਸਾਰਾ ਹੀ ਵੈਸ਼ਨੂੰ ਹੁੰਦਾ ਹੈ ਬਿਨਾਂ ਹੀ ਕਿਸੀ ਸ਼ਰਾਬ ਤੋਂ ਕਿਉਂਕਿ ਸ਼ਰਾਬ ਸਿਹਤ ਨੂੰ ਹਾਨੀ ਪਹੁੰਚਾਉਂਦੀ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਵੱਡੇ ਜਸ਼ਨਾਂ ਵਿੱਚ ਲੋਕੀ ਡੀ ਜੇ ਲਾਉਂਦੇ ਹਨ ਜੋ ਕਿ ਬਜੁਰਗਾਂ ਦੇ ਕੰਨਾਂ ਲਈ ਅਤੇ ਉਹਨਾਂ ਦੀ ਸਿਹਤ ਲਈ ਅਤੇ ਹੋਰ ਬੰਦਿਆਂ ਦੀ ਵਾਤਾਵਰਨ ਲਈ ਬਹੁਤ ਹੀ ਹਾਨੀ ਪਹੁੰਚਾਉਂਦਾ ਹੈ ਤਾਂ ਇਸ ਕਰਕੇ ਮੈਂ ਛੋਟੇ ਜਸ਼ਨ ਕਰਨਾ ਪਸੰਦ ਕਰਦਾ ਹਾਂ ਜੋ ਕਿ ਸ਼ਾਂਤ ਸੁਭਾਵ ਦੇ ਹੋਣ ਅਤੇ ਉਹਨਾਂ ਵਿੱਚ ਮੈਂ ਆਪਣੇ ਆਪ ਅਤੇ ਆਪਣੇ ਫੈਮਲੀ ਮੈਂਬਰਾਂ ਨਾਲ ਇੰਨਜੋਆਏ ਕਰ ਸਕਾ ਧੰਨਵਾਦ